ਟੈਕਨੋਲੋਜੀ ਟਰਾਂਸਪੋਰਟ ਨੇ ਸਾਡਾ ਕੰਮ ਬਹੁਤ ਆਸਾਨ ਕੀਤਾ ਹੈ ਜਿਵੇਂ ਕਿ ਪਿਛਲੇ ਜ਼ਮਾਨੇ ਵਿੱਚ ਕੋਈ ਕਮਰਾ ਟਿਕਟ ਬੁੱਕ ਸਿਨਮੇ ਘਰਾਂ ਵਿੱਚ ਟਿਕਟ ਬੁੱਕ ਕੋਈ ਕਮਰਾ ਹੋਟਲ ਦੇ ਵਿਚ ਕੋਈ ਕਮਰਾ ਲੈਣਾ ਹੋਵੇ ਤਾਂ ਸਾਨੂੰ ਬਹੁਤ ਬੜੀਆਂ ਲਾਈਨਾਂ ਵਿਚ ਲੱਗਣਾ ਪੈਂਦਾ ਸੀ ਅੱਜ ਕੱਲ੍ਹ ਅਸੀਂ ਔਨਲਾਈਨ ਬੁੱਕ ਹੋਟਲ ਬੁੱਕ ਕਰ ਸਕਦੇ ਹਨ ਔਨਲਾਈਨ ਪਲੈਟਫਾਰਮ ਨੰਬਰ ਦੇਖ ਜਾਣ ਸਕਦੇ ਹਨ ਔਨਲਾਈਨ ਬੱਸ ਡਿਪੋਰਟ ਕਰ ਸਕਦੇ ਹਨ